ਜਿਵੇਂ ਕਿ ਮੈਨੂੰ ਸ਼ੁਰੂ ਤੋਂ ਹੀ ਪੌਦੇ ਲਗਾਉਣ ਦਾ ਹੈ ਨਾ ਸਬਜ਼ੀਆਂ ਲਗਾਉਣ ਦਾ ਬਹੁਤ ਸ਼ੌਕ ਸੀਗਾ ਹੈ ਨਾ ਅਤੇ ਇਹਨਾਂ ਨੂੰ ਜਿਵੇਂ ਮੌਸਮ ਬਦਲਦੇ ਮੌਸਮ ਜਿਵੇਂ ਅਲੱਗ ਅਲੱਗ ਮੌਸਮ ਹੁੰਦੇ ਹੈ ਨਾ ਉਸ ਹਿਸਾਬ ਨਾਲ ਜਿਹੜਾ ਇਹਨਾਂ ਦੀਆਂ ਸਾਵਧਾਨੀਆਂ ਵੀ ਅਲੱਗ ਅਲੱਗ ਹੀ ਹੁੰਦੀਆਂ ਜਦੋਂ ਆਪਣਾ ਗਰਮੀ ਦਾ ਮੌਸਮ ਹੁੰਦਾ ਹੈ ਨਾ ਉਦੋਂ ਇਹਨਾਂ ਨੂੰ ਜਿਹੜੇ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਆ ਹੈ ਨਾ ਅਤੇ ਜਦੋਂ ਸਿਆਲ ਦਾ ਮੌਸਮ ਹੁੰਦਾ ਹੈ ਸਰਦੀ ਹੁੰਦੀ ਹੈ ਅਤੇ ਉਦੋਂ ਇਹਨਾਂ ਦੀ ਪਾਣੀ ਦੀ ਜਿਹੜੀ ਲਿਮਿਟ ਉਹ ਘੱਟ ਹੀ ਹੁੰਦੀ ਇਹਨਾਂ ਨੂੰ ਬਹੁਤੀ ਲੋੜ ਨਹੀਂ ਪੈਂਦੀ ਪਾਣੀ ਦੀ ਹੈ ਨਾ ਉਹ ਸਿਆਲ ਵਾਲੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਨੂੰ ਪਾਣੀ ਦੀ ਲੋੜ ਘੱਟ ਹੀ ਪੈਂਦੀ ਹੈ ਅਤੇ ਜਦੋਂ ਬਰਸਾਤ ਦਾ ਮੌਸਮ ਆਉਂਦਾ ਉਦੋਂ ਇਹਨਾਂ ਦੇ ਵਿੱਚ ਪਾਣੀ ਸਾਨੂੰ ਐਨੀ ਲੋੜ ਨਹੀਂ ਪੈਂਦੀ ਕਿਉਂਕਿ ਬਰਸਾਤੀ ਜਿਹੜਾ ਪਾਣੀ ਹੁੰਦਾ ਆਲਰੇਡੀ ਉਹੀ ਬਹੁਤਾ ਹੋ ਜਾਂਦਾ ਉਹਨਾਂ ਲਈ ਅਤੇ ਇੱਦਾਂ ਹੀ ਪਾਣੀ ਦੀ ਘੱਟ ਜਾਂ ਵੱਧ ਹੈ ਨਾ ਵਰਤੋਂ ਦੇ ਬਾਰੇ ਅਲੱਗ ਅਲੱਗ ਮੌਸਮਾਂ 'ਤੇ ਡਿਪੈਂਡ ਕਰਦਾ ਕਿ ਹੈ ਨਾ ਕਿਹੜੇ ਮੌਸਮ 'ਚ ਜ਼ਿਆਦਾ ਚਾਹੀਦਾ ਕਿਹੜੇ ਮੌਸਮ 'ਚ ਘੱਟ ਚਾਹੀਦਾ ਅਤੇ ਜੇ ਆਪਾਂ ਗੱਲ ਕਰੀਏ ਗੱਲ ਖਾਦਾਂ ਦੀ ਹੈ ਨਾ ਜਿਹੜੀਆਂ ਰਸਾਇਣਿਕ ਖਾਦਾਂ ਜੈਵਿਕ ਖਾਦਾਂ ਹੈ ਨਾ ਸਾਨੂੰ ਉਹ ਪਾਉਣੀਆਂ ਚਾਹੀਦੀਆਂ ਜਿਵੇਂ ਪਸ਼ੂਆਂ ਦੀ ਰਹਿੰਦ ਖੂੰਹਦ ਹੋ ਗਈ ਹੈ ਨਾ ਇਹ ਪਾਉਣੀਆਂ ਚਾਹੀਦੀਆਂ ਗੰਡੋਇਆਂ ਦੀਆਂ ਵੀ ਖਾਦਾਂ ਹੈ ਨਾ ਇਹ ਪਾਉਣੀਆਂ ਚਾਹੀਦੀਆਂ ਜੇਕਰ ਆਪਾਂ ਹੁਣ ਵਿਗਿਆਨਕ ਖਾਦਾਂ ਪਾਵਾਂਗੇ ਹੈ ਨਾ ਉਹ ਸਾਡੇ ਲਈ ਵੀ ਹਾਨੀਕਾਰਕ ਹੈ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਥੋੜ੍ਹੇ ਜਿਹੇ ਤੱਤ ਆ ਸਬਜ਼ੀਆਂ 'ਚ ਆ ਹੀ ਜਾਂਦੇ ਨੇ ਅਤੇ ਉਹ ਫਿਰ ਸਾਡੇ ਲਈ ਹਾਨੀਕਾਰਕ ਹੁੰਦੇ ਨੇ ਅਤੇ ਜਿਹੜੀਆਂ ਰਸਾਇਣਿਕ ਖਾਦਾਂ ਉਹ ਸਾਡੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹਨੂੰ ਵੀ ਵਧਾਉਂਦੀਆਂ ਨੇ ਹੈ ਨਾ ਕਾਫੀ ਟਾਈਮ ਤੱਕ ਇਹ ਜਿਹੜੇ ਇਹਨਾਂ ਦਾ ਅਸਰ ਜ਼ਮੀਨ 'ਚ ਰਹਿੰਦਾ ਆ ਅਤੇ ਜਿਹੜੀ ਵਿਗਿਆਨਕ ਹੈ ਉਹ ਤਾਂ ਸਾਡੀ ਸਿਹਤ ਖਰਾਬ ਕਰਦੀਆਂ ਨੇ ਸਿਹਤ ਖਰਾਬ ਕਰਨ ਦੇ ਕਰਨ ਨਾਲ ਨਾਲ ਇਹ ਜਿਹੜਾ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹਨੂੰ ਵੀ ਘਟਾਉਂਦੀਆਂ ਨੇ ਹੈ ਨਾ ਇਹਨਾਂ ਦੇ ਬਹੁਤ ਜ਼ਿਆਦਾ ਲੋਸ ਹੁੰਦੇ ਨੇ ਸਾਨੂੰ ਅਤੇ ਜ਼ਿਆਦਾਤਰ ਸਾਨੂੰ ਰਸਾਇਣਿਕ ਹੀ ਖਾਦਾਂ ਵਰਤਣੀਆਂ ਚਾਹੀਦੀਆਂ ਨੇ ਅਤੇ ਜਿਹੜੀਆਂ ਇਹ ਰਸ ਖ ਖਾਦਾਂ ਹੈ ਸਾਨੂੰ ਲੋੜ ਪੈਣ 'ਤੇ ਵਰਤਣੀਆਂ ਚਾਹੀਦੀਆਂ ਨੇ ਇਹ ਨਹੀਂ ਕਿ ਆਪਾਂ ਬੇਬਸੂਲੀ ਬੇਫਜ਼ੂਲ ਇਹਨਾਂ ਦੇ ਵਿੱਚ ਪਾਈ ਜਾਈਏ ਹੈ ਨਾ ਜਦੋਂ ਲੋੜ ਹੋਵੇ ਉਸ ਸਮੇਂ ਇਹਨਾਂ ਨੂੰ ਪਾਉਣਾ ਚਾਹੀਦਾ ਆ ਇੱਦਾਂ ਹੋਰ ਵੀ ਕਈ ਸਾਵਧਾਨੀਆਂ ਹੁੰਦੀਆਂ ਨੇ ਪਾਣੀ ਦੇਣਾ ਹੈ ਨਾ ਟਾਇਮ ਟੂ ਟਾਇਮ ਇਹਨਾਂ ਦੀ ਗੋਡੀ ਵੀ ਕਰਨੀ ਟਾਇਮ ਟੂ ਟਾਇਮ ਜਦੋਂ ਲੋੜ ਹੋਵੇ ਹੈ ਨਾ ਗੋਡੀ ਕਰਨ ਦੀ ਉਦੋਂ ਗੋਡੀ ਵੀ ਕਰਨੀ ਚਾਹੀਦੀ ਹੈ ਇੱਦਾਂ ਫਿਰ ਜਦੋਂ ਆਪਾਂ ਇਹ ਸਾਰੀਆਂ ਸਾਵਧਾਨੀਆਂ ਦਾ ਖਿਆਲ ਰੱਖਦੇ ਹਾਂ ਜਿਹੜੀ ਸਾਡੀ ਸਬਜ਼ੀ ਹੈ ਉਹ ਵੀ ਬਹੁਤ ਵਧੀਆ ਹੁੰਦੀ ਹੈ ਹੈ ਨਾ ਜਿਹੜੇ ਉਹਦੇ ਬੂਟੇ ਹੈ ਉਹ ਵੀ ਵਧੀਆ ਹੁੰਦੇ ਹੈ ਅਤੇ ਸਾਡਾ ਕਾਫੀ ਸਮਾਂ ਲੰਘ ਜਾਂਦਾ ਫਿਰ ਇੱਦੀਂ